ਜੇ ਸਾਡੇ ਪਿੰਡ ਦੇ ਕਿਸੇ ਵਿਅਕਤੀ ਨੂੰ ਕੁੱਤੇ ਨੇ ਕੱਟ ਲਿਆ ਤਾਂ ਸਭ ਤੋਂ ਪਹਿਲਾਂ ਮੈਂ ਐਬੂਲੈਂਸ ਨੂੰ ਫੋਨ ਕਰਾਂਗੀ ਅਤੇ ਐਬੂਲੈਂਸ ਦੇ ਆਉਣ ਤੱਕ ਮੈਂ ਉਸ ਵਿਅਕਤੀ ਦਾ ਚੰਗੇ ਤਰੀਕੇ ਨਾਲ ਧਿਆਨ ਰੱਖਾਂਗੀ ਉਸਨੂੰ ਪਾਣੀ ਆਦਿ ਪਿਲਾਵਾਂਗੀ ਅਤੇ ਬੇਹੋਸ਼ ਹੋਣ ਨਹੀਂ ਦਿਆਂਗੀ ਉਸ ਦੀ ਦੇਖਭਾਲ ਵਧੀਆ ਤਰੀਕੇ ਨਾਲ ਕਰਾਂਗੀ ਜਿੱਥੇ ਕੁੱਤੇ ਨੇ ਕੱਟਿਆ ਹੋਇਆ ਉੱਥੇ ਚੰਗੀ ਤਰ੍ਹਾਂ ਨਾਲ ਕੱਪੜਾ ਬੰਨ ਤ ਬੰਨਾਗੀ ਤਾਂ ਕਿ ਉਸ ਦਾ ਖੂਨ ਜ਼ਿਆਦਾ ਨਾ ਵਗੇ ਅਤੇ ਉਸ ਨੂੰ ਕੋਈ ਮੈਡੀਸਿਨ ਕੋਈ ਕਿਸੇ ਤਰ੍ਹਾਂ ਦੀ ਪੇਨ ਕਿਲਰ ਵੀ ਦਿਆਂਗੀ ਜਿਹਦੇ ਨਾਲ ਉਸ ਨੂੰ ਦਰਦ ਜ਼ਿਆਦਾਤਰ ਮਹਿਸੂਸ ਨਾ ਹੋਵੇ ਉਸ ਨਾਲ ਗੱਲਾਂ ਬਾਤਾਂ ਕਰਦੀ ਰਹਾਂਗੀ ਤਾਂ ਕਿ ਉਹ ਬੇਹੋਸ਼ ਨਾ ਹੋਵੇ ਅਤੇ ਤਨ ਠੀਕ ਰਹੇ ਹੋਸ਼ ਵਿੱਚ ਰ ਹੇਤੇ ਜਦ ਐਂਬੂਲੈਂਸ ਆਵੇਗੀ ਤਾਂ ਉਸ ਨੂੰ ਐਬੂਲੈਂਸ ਵਿੱਚ ਬਿਠਾ ਕੇ ਉਸ ਦੇ ਨਾਲ ਜਾਵਾਂਗੀ ਅਤੇ ਉਸ ਦਾ ਵਧੀਆ ਤਰੀਕੇ ਨਾਲ ਇਲਾ ਇਲਾਜ ਕਰਵਾਵਾਂਗੀ ਵਧੀਆ ਡਾਕਟਰਾਂ ਨੂੰ ਦੱਸਾਂਗੀ ਅਤੇ ਉਸ ਨੂੰ ਵਧੀਆ ਤਰੀਕੇ ਨਾਲ ਇਲਾਜ ਕਰਵਾ ਕੇ ਘਰ ਵਾਪਸੀ ਲਿਆਵਾਂਗੀ ਅਤੇ ਘਰ ਆ ਕੇ ਵੀ ਉਸ ਦੀ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਦੀ ਰਹਾਂਗੀ